ਹਾਂਜੀ ਹਾਂਜੀ ਕੋਲ ਬੋਲ ਰਿਹਾ ਜੀ

ਹਾਂਜੀ ਹਾਂ ਹਾਂਜੀ ਹਾਂਜੀ ਅਸੀਂ ਤਰਨਤਾਰਨ ਗੁਰਦੁਆਰਾ ਸਾਹਿਬ ਤੋਂ ਬੋਲ ਰਹੇ ਜੀ ਓਕੇ ਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਹਾਂਜੀ ਹਾਂਜੀ ਇਹ ਗੁਰਦੁਆਰਾ ਸਾਹਿਬ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਜਿਹੜੇ ਇਹ ਉਹਨਾ ਨੇ ਬਣਵਾਇਆ ਜੀ ਅਤੇ ਉਹਨਾ ਨੇ ਇੱਥੇ ਸੇਵਾ ਕੀਤੀ ਸਾਰੀ ਜਿੰਨੀ ਸੇਵਾ ਉਹਨਾ ਨੇ ਆਪਣੇ ਹੱਥੀ ਕੀਤੀ ਆ ਇੱਥੇ ਬਹੁਤ ਸੋਹਣਾ ਦਰਬਾਰ ਹੈ ਜਿਹਦੇ ਵਿੱਚ ਕੀਰਤਨ ਸਾਰਾ ਦਿਨ ਕੀਰਤਨ ਚਲਦਾ ਰਹਿੰਦਾ ਅਤੇ ਇੱਥੇ ਨਾ ਇੱਕ ਆਪਣਾ ਜਿਹੜਾ ਸਰੋਵਰ ਹੈ ਨਾ ਜੀ ਜਿੱਥੇ ਸੰਗਤ ਇਸ਼ਨਾਨ ਕਰਦੀ ਆ ਸਰੋਵਰ ਹੈ ਬਹੁਤ ਵੱਡਾ ਯਾਨੀ ਕਿ ਜਿੰਨੇ ਗੁਰਦੁਆਰਾ ਸਾਹਿਬ ਪਹਿਲਾਂ ਦੇਖੇ ਹੋਣਗੇ ਓਹ ਸਾਰੇ ਗੁਰਦੁਆਰਾ ਸਾਹਿਬ ਨਾਲੋਂ ਇਹ ਸਰੋਵਰ ਬਹੁਤ ਵੱਡਾ ਜੀ ਅਤੇ ਪਾਸੇ ਉਹਨਾ ਦੇ ਵਰਾਂਡੇ ਬਣੇ ਹੋਏ ਆ ਰੈਸਟ ਕਰਨ ਵਾਸਤੇ ਇੱਥੇ ਜਗ੍ਹਾ ਵਾ ਇੱਥੇ ਗੁਰੂ ਸਾਹਿਬ ਨੇ ਇੱਥੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਥੇ ਲੰਗਰ ਵੀ ਚੌਵੀ ਘੰਟੇ ਚੱਲਦਾ ਜੀ ਚੌਵੀ ਘੰਟੇ ਜਿੱਦਾ ਤੁਸੀਂ ਮਰਜੀ ਆਓ ਤੁਹਾਨੂੰ ਲੰਗਰ ਤੁਹਾਡੇ ਰਹਿਣ ਵਾਸਤੇ ਰਿਹਾਇਸ਼ ਪੂਰਾ ਪ੍ਰਬੰਧ ਹੋਊਗਾ ਇੱਥੇ ਜਿੱਦਾਂ ਵੀ ਆਓ ਜਿਹੜਾ ਸੇਵਾਦਾਰ ਡਿਊਟੀ 'ਤੇ ਹੋਊਗਾ ਓਹਨੂੰ ਤੁਸੀਂ ਦੱਸ ਦੇਣਾ ਕੇ ਅਸੀਂ ਇੱਥੇ ਅਸੀਂ ਰਹਿਣਾ ਰਾਤ ਇੱਥੇ ਗੁਰਦੁਆਰਾ ਸਾਹਿਬ ਦੇਖਣ ਦੇ ਲਾਇਕ ਆ ਹਾਂਜੀ ਹਾਂਜੀ ਹਾਂਜੀ ਹਾ ਹਾਂਜੀ ਨਹੀਂ ਨਹੀਂ ਇੱਥੇ ਕੋਈ ਮੁਸ਼ਕਿਲ ਨਹੀਂ ਗੁਰੂ ਸਾਹਿਬ ਦੀ ਬੜੀ ਕਿਰਪਾ ਜੀ ਤੁਸੀਂ ਦੇਖੋਗੇ ਤੁਸੀਂ ਕਹਿਣਾ ਵਾਹ ਬਹੁਤ ਸੋਹਣਾ ਜੀ ਇਹ ਜੀ ਇਹ ਬਹੁਤ ਸੋਹਣਾ ਇੱਥੇ ਹੋਰ ਵੀ ਹਾਂਜੀ ਨੇ ਨੇੜੇ ਨੇੜੇ ਹੋਰ ਵੀ ਗੁਰਦੁਆਰਾ ਸਾਹਿਬ ਹੈਗੇ ਜੀ ਆਓ ਤੁਸੀਂ ਜਿੱਦਣ ਮਰਜ਼ੀ ਆਓ ਹਾਂਜੀ ਜੀ ਆਇਆਂ ਨੂੰ ਜੀ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਓਕੇ ਥੈਂਕ ਯੂ ਧੰਨਵਾਦ ਜੀ ਧੰਨਵਾਦ